ਮੇਰੇ ਤਾਇਆ ਜੀ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਉਸਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਪਰ ਇੱਕ ਗੰਭੀਰ ਰੂਪ ਵਿੱਚ ਉਸਨੂੰ ਸਿਰ ਵਿੱਚ ਸੱਟ ਲੱਗੀ ਜਦੋਂ ਅਸੀਂ ਹੋਸਪਿਟਲ ਪਹੁੰਚੇ ਤਾਂ ਉਸ ਹੋਸਪਿਟਲ ਵਿੱਚ ਹਰੇਕ ਰੂਪ ਵਿੱਚ ਪੂਰਨ ਸੁਵਿਧਾਵਾਂ ਮੌਜੂਦ ਸਨ ਪਰ ਬਰੇਨ ਦੇ ਡਾਕਟਰ ਸਿਰ ਦੇ ਡਾਕਟਰ ਮੌਜੂਦ ਨਹੀਂ ਸਨ ਉਹਨਾਂ ਨੇ ਇੱਕ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹਿਆ ਹੋਇਆ ਸੀ ਸਾਰੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਉਸ ਨੂੰ ਕੋਈ ਇਲਾਜ ਨਾ ਮਿਲਿਆ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੋਸਪਿਟਲਾਂ ਵਿੱਚ ਰਜਿਸਟਰਾਂ 'ਤੇ ਨਹੀਂ ਪੂਰਨ ਸੁਵਿਧਾਵਾਂ ਬਲਕਿ ਪੂਰਨ ਸੁਵਿਧਾ ਹੋਣ ਦੇ ਬਾਵਜੂਦ ਉਸਨੂੰ ਟਰੀਟਮੈਂਟ ਨਹੀਂ ਮਿਲਿਆ ਕਿਉਂਕਿ ਉਸ ਸਮੇਂ ਉੱਥੇ ਡਾਕਟਰ ਹੀ ਮੌਜੂਦ ਨਹੀਂ ਸਨ ਕਿਉਂਕਿ ਉਹਨਾਂ ਨੇ ਆਪਣਾ ਪ੍ਰਾਈਵੇਟ ਕਲੀਨਿਕ ਖੋਲ੍ਹਿਆ ਹੋਇਆ ਸੀ ਜਿਸ ਕਰਕੇ ਹੋਸਪਿਟਲ ਵਿੱਚ ਦਿਮਾਗ ਦੇ ਡਾਕਟਰ ਮੌਜੂਦ ਨਹੀਂ ਸਨ ਪੂਰਨ ਸੁਵਿਧਾ ਹੀ ਨਹੀਂ ਜ਼ਰੂਰੀ ਉੱਥੇ ਡਾਕਟਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਧੰਨਵਾਦ